ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਜੀ ਤੁਹਾਡਾ ਨੰਬਰ ਅਸੀਂ ਵੀ ਤੁਸੀਂ ਸਾਡੇ ਫਰੈਂਡ ਸੀ ਅਸੀਂ ਵੀ ਸ਼ੋਅ ਲਗਾਉਣਾ ਸੀਗਾ ਕਿ ਵੀ ਵਿਆਹ ਸਾਡੇ ਵੀ ਮੇਰੇ ਬ੍ਰਦਰ ਦਾ ਵਿਆਹ ਗਾ ਉਹਨਾਂ ਨੇ ਸਾਡੀ ਰਿਸ਼ਤੇਦਾਰਾਂ ਦੀ ਡਿਮਾਂਡ 'ਤੇ ਵੀ ਤੁਹਾਡਾ ਸ਼ੋਅ ਬੁੱਕ ਕਰਵਾਇਆ ਗਿਆ ਵੀ ਕਿਹਾ ਹੈਗਾ ਵੀ ਅਸੀਂ ਉਹ ਸਿੰਗਰ ਨੂੰ ਹੀ ਬੁੱਕ ਕਰਨਾ ਗਾ ਤੁਸੀਂ ਕਿੰਨੇ ਕਿੰਨੇ ਪੈਸੇ ਤੱਕ ਕਰੋਗੇ ਵੀ ਇੱਕ ਤਾਂ ਇੱਕ ਸ਼ੋ ਦੇ ਕਿੰਨੇ ਪੈਸੇ ਲੈਂਦੇ ਹੋਗੇ ਹਾਂਜੀ ਉਹ ਤਾਂ ਹੈਗਾ ਫਿਰ ਵੀ ਤੁਸੀਂ ਸਾਨੂੰ ਦੱਸ ਦਿਓ ਕਿਉਂ ਵੀ ਤੁਹਾਨੂੰ ਸਾਡੇ ਸਾਰੇ ਰਿਸ਼ਤੇਦਾਰ ਜਿੰਨੇ ਵੀ ਹੈ ਜਿਹੜੇ ਮੇਰੇ ਬ੍ਰਦਰ ਆ ਉਹਨਾਂ ਨੂੰ ਉਹਨਾਂ ਨੂੰ ਸੁਣਨਾ ਵੀ ਬਹੁਤ ਚੰਗਾ ਲੱਗਦਾ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਗੇ ਹਾਂਜੀ ਉਹ ਤਾਂ ਹੈਗਾ ਗਾ ਨਾ ਪਰ ਤੁਹਾਨੂੰ ਮਾੜਾ ਉੱਪਰਲਾ ਫਿਰ ਵੀ ਦੱਸ ਦਿਓ ਮਾੜਾ ਮੋਟਾ ਹਾਂ ਵੀ ਤੁਹਾਡਾ ਕਿੰਨੇ ਟਾਈਮ ਤੁਸੀਂ ਕਿੰਨੇ ਘੰਟਿਆਂ ਦੇ ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦੇ ਹੋ ਕਿੰਨੇ ਅਸੀਂ ਚਾਰ ਗੀਤ ਹੀ ਬੁੱਕ ਕਰਵਾਉਂਣੇ ਹੈਗੇ ਹਾਂਜੀ ਤੁਸੀਂ ਸਾਨੂੰ ਪੱਕਾ ਦੱਸ ਦਿਓ ਸਾਡਾ ਵਿਆਹ ਵੀ ਵਿਆਹ ਅੱਗੇ ਬਸ ਵੀਹ ਸਤੰਬਰ ਨੂੰ ਹੀ ਹੈਗਾ ਥੈਂਕ ਯੂ ਥੈਂਕ ਯੂ ਸੋ ਮੱਚ ਸਰ ਪੈਲਿਸ ਸਾਡੇ ਤਾਂ ਨੇੜੇ ਹੈ ਆਪਣੇ ਬਰਨਾਲੇ ਜ਼ਿਲ੍ਹੇ 'ਚ ਕਰਵਾਏ ਹੋਏ ਹੈਗੇ ਠੀਕ ਹੈ ਸਰ ਥੈਂਕ ਯੂ